ਫ਼ਾਜ਼ਿਲਕਾ ਦੇ ਵਿੱਚ ਆਵਾਜਾਈ ਦੇ ਸਾਧਨ ਹਨ ਜਿਵੇਂ ਕਿ ਕਾਰ ਮੋਟਰਸਾਈਕਲ ਸਕੂਟਰ ਬੱਸਾਂ ਰੇਲ ਗੱਡੀ ਆਟੋ ਹਨ ਰੇਲ ਗੱਡੀ ਅਤੇ ਬੱਸਾਂ ਰਾਹੀਂ ਅਸੀਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਫ਼ਾਜ਼ਿਲਕਾ ਤੋਂ ਜਲਾਲਾਬਾਦ ਅਬੋਹਰ ਜਾਂ ਦੂਰੀ ਵਾਲੇ ਸ਼ਹਿਰਾਂ ਵਿੱਚ ਜਾ ਸਕਦੇ ਹਾਂ ਸਕੂਟਰ ਮੋਟਰਸਾਈਕਲ ਨਾਲ ਵੀ ਅਸੀਂ ਲੋਕਲ ਸ਼ਹਿਰ ਵਿੱਚ ਅਤੇ ਬਾਹਰ ਵੀ ਜਾ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਆਟੋ ਰਿਕਸ਼ਾ 'ਤੇ ਪੈਸੇ ਭਰ ਕੇ ਫ਼ਾਜ਼ਿਲਕਾ ਦੇ ਵਿੱਚ ਘੁੰਮ ਸਕਦੇ ਹਾਂ ਧੰਨਵਾਦ ਜੀ